ਖੇਡਾਂ ਖੇਡਣ ਦੇ ਨਾਲ ਲੋਕਾਂ ਨੂੰ ਸਟਰੈੱਸ ਤੋਂ ਰਾਹਤ ਮਿਲਦੀ ਹੈ ਚਿੰਤਾ ਤੋਂ ਅਤੇ ਉਹ ਆਨੰਦਮਈ ਤਰੀਕਾ ਹੋ ਸਕਦਾ ਇੱਕ ਉਹ ਇੱਦਾਂ ਹੈ ਕਿ ਜਦੋਂ ਹੁਣ ਬੰਦਾ ਖੇਡ ਦੇ ਵਿੱਚ ਲੱਗਿਆ ਹੋਇਆ ਰੁਝਾਨ ਦੇ ਵਿੱਚ ਲੱਗਿਆ ਹੋਇਆ ਕਿਸੇ ਕੰਮ ਦੇ ਵਿੱਚ ਤਾਂ ਉਹ ਬਾਕੀ ਚਿੰਤਾਵਾਂ ਨੂੰ ਛੱਡ ਦਿੰਦਾ ਅਤੇ ਉਹ ਉਸ ਜਗ੍ਹਾ ਦੇ ਉੱਤੇ ਇਕਾਗਰ ਹੋ ਕੇ ਖੇਡਦਾ ਅਤੇ ਹੈ ਨਾ ਵੀ ਵੀ ਹਾਂ ਮੈਂ ਇਹ ਗੇਮ ਖੇਲਣ ਆਇਆ ਅਤੇ ਮੈਂ ਜਿੱਤਣੀ ਹੈ ਮੈਂ ਬਾਕੀ ਵੀ ਮੇਰੇ ਨਾਲ ਖੇਡ ਰਹੇ ਨੇ ਤਾਂ ਉਹਨਾਂ ਦੇ ਨਾਲ ਮਿਲ ਜੁਲ ਕੇ ਜਦੋਂ ਆਪਾਂ ਕ ਉਹ ਕਰਦੇ ਹਾਂ ਤਾਂ ਆਪਣਾ ਜਿਹੜਾ ਹੈਗਾ ਰੁਝਾਨ ਉਸ ਚੀਜ਼ ਵੱਲ ਚਲਿਆ ਜਾਂਦਾ ਧਿਆਨ ਸਾਰਾ ਉੱਧਰ ਚਲਿਆ ਜਾਂਦਾ ਜਿਹਦੇ ਨਾਲ ਕੀ ਹੁੰਦਾ ਇੱਕ ਤਾਂ ਆਪਣਾ ਜਿੱਥੇ ਸਾਨੂੰ ਜਿਹੜੀ ਚੀਜ਼ ਦਿੱਕਤ ਦੇ ਰਹੀ ਹੁੰਦੀ ਟੈਂਸ਼ਨ ਦੇ ਰਹੀ ਹੁੰਦੀ ਹੈ ਸਟਰੈੱਸ ਦਿੰਦੀ ਹੁੰਦੀ ਹੈ ਓਹ ਤੋਂ ਸਾਡਾ ਧਿਆਨ ਹਟ ਜਾਂਦਾ ਦੂਜੀ ਗੱਲ ਜਦੋਂ ਅਸੀਂ ਖੇਡਦੇ ਹਾਂ ਕੁੱਦਦੇ ਹਾਂ ਤਾਂ ਓਹਦੇ ਨਾਲ ਕੀ ਹੁੰਦਾ ਸਾਡੀ ਬੌਡੀ ਆ ਜਿਹੜੀ ਓਹਦੇ ਵਿੱਚ ਮੂਵਮੈਂਟ ਹੁੰਦੀਆਂ ਨੇ ਤਾਂ ਬੌਡੀ ਜਿਹੜੀ ਹੈਗੀ ਹੈ ਓਹ ਆਪਣੇ ਆਪ ਦੇ ਵਿੱਚ ਜਿਹੜੀ ਹੈਗੀ ਹੈ ਏ ਐਨਰਜੀ ਜਿਹੜੀ ਹੈਗੀ ਹੈ ਉਹ ਯੂਜ਼ ਹੁੰਦੀ ਹੈ ਅਤੇ ਬੰਦਾ ਜਿਹੜਾ ਹੈਗਾ ਉਹ ਐਨਰਜੀ ਜਦੋਂ ਯੂਜ਼ ਕਰਦਾ ਉੱਥੇ ਤਾਂ ਓਹਦਾ ਮਤਲਬ ਕਿ ਫਰਦਰ ਅੱਗੇ ਮ ਅੱਗੇ ਜਾ ਕੇ ਉਹ ਐਨਰਜੀ ਕਿਤੇ ਹੋਰ ਨਹੀਂ ਵੇਸਟ ਕਰੇਗਾ ਕਹਿਣ ਦਾ ਭਾਵ ਬੈਠਾ ਬੈਠਾ ਨਹੀਂ ਓਹਨੇ ਸੋਚੀ ਜਾਣਾ ਸੀ ਸੋਚਣ ਦੀ ਬਜਾਏ ਉਹ ਖੇਡਣ 'ਚ ਲੱਗਿਆ ਹੋਇਆ ਰੁਝਾਨ ਉੱਧਰ ਹੈ ਜਿਹਦੇ ਨਾਲ ਕੀ ਹੋਏਗਾ ਓਹਦੀ ਐਨਰਜੀ ਉੱਧਰ ਯੂਜ਼ ਹੋ ਜੁਗੀ ਸੋ ਇਵੇਂ ਹੀ ਓਹਦਾ ਜਿਹੜਾ ਹੈਗਾ ਦਿਨ ਢੱਲ ਜਾਂਦਾ ਮਤਲਬ ਇਹ ਹੈ ਕਿ ਵੀ ਜੇ ਬੰਦਾ ਫ੍ਰੀ ਹੈ ਵਿਹਲਾ ਤਾਂ ਓਹਨੂੰ ਉੱਧਰ ਲਾਇਆ ਜਾਵੇ ਤਾਂ ਉਹ ਓਹਦਾ ਸਮਾਂ ਨਿਕਲ ਜਾਂਦਾ ਜਿਹਦੇ ਨਾਲ ਕੀ ਹੁੰਦਾ ਬੰਦਾ ਚਿੰਤਾ ਫਿਕਰਾਵਾਂ ਦੇ ਵਿੱਚ ਟੈਂਸ਼ਨਾਂ ਦੇ ਵਿੱਚ ਨਹੀਂ ਪੈਂਦਾ ਉਹਨਾਂ ਤੋਂ ਮੁਕਤੀ ਮਿਲ ਜਾਂਦੀ ਹੈ